ਅੱਜ ਕੱਲ੍ਹ ਦੇ ਬੱਚੇ ਮੋਬਾਈਲ ਅਤੇ ਟੀ ਵੀ ਦੀ ਵਰਤੋਂ ਬਹੁਤ ਜ਼ਿਆਦਾ ਕਰਨ ਲੱਗ ਗਏ ਹਨ ਜ਼ਿਆਦਾਤਰ ਮੋਬਾਈਲ ਬੱਚੇ ਬਹੁਤ ਹੀ ਬਹੁਤ ਹੀ ਵਰਤੋਂ ਵਿੱਚ ਲੈਂਦੇ ਹਨ ਮੋਬਾਈਲ ਬੱਚਿਆਂ ਲਈ ਬਹੁਤ ਹੀ ਨੁਕਸਾਨਦਾਇਕ ਹੁੰਦਾ ਹੈ ਜੋ ਕਿ ਮੋਬਾਈਲ ਦਾ ਬੱਚਿਆਂ ਦੇ ਮਾਨਸਿਕ ਅਤੇ ਸਾਰੀਰਕ ਦੋਨੋਂ ਹੀ ਪ੍ਰਭਾਵ ਪੈਂਦੇ ਹਨ ਜਦੋਂ ਬੱਚੇ ਮੋਬਾਈਲ ਨਹੀਂ ਸਨ ਤਾਂ ਬੱਚੇ ਬਹੁਤ ਸਾਰੀਆਂ ਖੇਡਾਂ ਖੇਡਦੇ ਸਨ ਜਿਵੇਂ ਕਿ ਬਾਹਰ ਦੀ ਫੁੱਟਬੋਲ ਕ੍ਰਿਕੇਟ ਖੈਰ ਰੇਸ ਲਗਾਉਣਾ ਹੈ ਨਾ ਬਹੁਤ ਸਾਰੇ ਗੇਮਸ ਜੋ ਕਿ ਉਹ ਬਾਹਰ ਖੇਡਦੇ ਸਨ ਬ ਪਰ ਜਦੋਂ ਦਾ ਮੋਬਾਈਲ ਵਰਤੋਂ ਵਿੱਚ ਬੱਚਿਆਂ ਨੇ ਲਿਆ ਹੈ ਬੱਚੇ ਬਾਹਰ ਦੀਆਂ ਗੇਮਾਂ ਖੇਡਣਾ ਬਿਲਕੁਲ ਹੀ ਭੁੱਲ ਗਏ ਹਨ ਅਤੇ ਉਹ ਹੈ ਟੀ ਵੀ 'ਤੇ ਮੋਬਾਈਲ ਵਿੱਚ ਐਨਾ ਐਨਾ ਜ਼ਿਆਦਾ ਖੋ ਗਏ ਹਨ ਕਿ ਉਹ ਆਪਦੀ ਆਪਣੀ ਜ਼ਿੰਦਗੀ ਨੂੰ ਇੰਜੋਏ ਵੀ ਨਹੀਂ ਕਰ ਕਰਦੇ ਹਨ ਉਹ ਹੈ ਜਿਸ ਕਰਕੇ ਉਹਨਾਂ ਨੂੰ ਮਾਨਸਿਕ ਬਿਮਾਰੀਆਂ ਹੋ ਰਹੀਆਂ ਹਨ ਬੱਚੇ ਨੂੰ ਮੋਬਾਈਲ ਬਿਨਾਂ ਖਾਣਾ ਵੀ ਨਹੀਂ ਖਾਂਦੇ ਹਨ ਉਹ ਹਰ ਰੋਟੀ ਖਾਣ ਤੋਂ ਪਹਿਲਾਂ ਵੀ ਉਹਨਾਂ ਨੂੰ ਮੋਬਾਈਲ ਚਾ ਚਾਹੀਦਾ ਹੈ ਅਤੇ ਉਹ ਜਿਸ ਕਰਕੇ ਉਹ ਪਾਗਲਾਂ ਜਿਹੇ ਜਏ ਹੋ ਗਏ ਹਨ ਉਹ ਰੋਣ ਲੱਗ ਜਾਂਦੇ ਹਨ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਰੋਂਦੇ ਹਨ ਅਗਰ ਉਹਨਾਂ ਤੋਂ ਮੋਬਾਈਲ ਲੈ ਲਿਆ ਜਾਵੇ ਤਾਂ ਬਹੁਤ ਰੋਂਦੇ ਹਨ ਅਜਿਹੇ ਬਹੁਤ ਸਾਰੇ ਕੇਸ ਸਾਹਮਣੇ ਆਏ ਹਨ ਜਿਸ ਵਿੱਚ ਬੱਚੇ ਮੋਬਾਈਲ ਕਰਕੇ ਹੋਸਪਿਟਲਾਂ ਵਿੱਚ ਦਾਖਲ ਹਨ ਉਹ ਹੈ ਉਸ ਤਰ੍ਹਾਂ ਦੀ ਮੋਬਾਈਲ ਕਰਕੇ ਉਹ ਹੈ ਇੱਕ ਕੋਮਾ 'ਚ ਜਾ ਰਹੇ ਹਨ ਇਸ ਲਈ ਸਾਨੂੰ ਮੋਬਾਈਲ ਅਤੇ ਟੀ ਵੀ ਦੀ ਵਰਤੋਂ ਘੱਟ ਤੋਂ ਘੱਟ ਕਰਕੇ ਬਾਹਰ ਖੇਡ ਖੇਡਣੇ ਚਾਹੀਦੇ ਹਨ